ਹੈਲੋ ਨਮਸਕਾਰ ਸਰ ਸਰ ਤੁਸੀਂ ਵਿਰਾਸਤ ਅਕੈਡਮੀ ਤੋਂ ਬੋਲਦੇ ਪਏ ਹੋ ਸਰ ਮੈਂ ਨਾ ਸ਼ਬਦ ਜਨੇਜਾ ਦੀ ਮੰਮਾ ਬੋਲਦੀ ਪਈ ਹਾਂ ਸਰ ਮੇਰਾ ਬੇਟਾ ਨਾ ਤਿੰਨ ਮਹੀਨਿਆਂ ਤੋਂ ਤੁਹਾਡੇ ਕੋਲ ਨਾ ਮਿਊਜਿਕ ਸਿੱਖਣ ਆਉਂਦਾ ਪਿਆ ਪਰ ਮੈਂ ਤਿੰਨ ਮਹੀਨਿਆਂ ਤੋਂ ਉਸਨੂੰ ਦੇਖ ਰਹੀ ਹਾਂ ਕਿ ਉਸ ਵਿੱਚ ਕੋਈ ਮਤਲਬ ਇਮਪਰੂਵਮੈਂਟ ਨਹੀਂ ਹੈਗੀ ਨਹੀਂ ਸਰ ਉਸਨੂੰ ਕੁਛ ਵੀ ਨਹੀਂ ਆ ਰਿਹਾ ਇ ਨਾ ਕੋਈ ਸਰਗਮ ਢੰਗ ਨਾਲ ਆ ਰਹੀ ਨਾ ਕੋਈ ਰਾਗ ਵਗੈਰਾ ਕੁਛ ਵੀ ਨਹੀਂ ਕਰ ਰਿਹਾ ਅਤੇ ਉਹ ਤਿੰਨ ਮਹੀਨਿਆਂ ਤੋਂ ਆਉਂਦਾ ਪਿਆ ਸਰ ਬੱਚੇ 'ਚ ਜੇ ਇਮਪਰੂਵਮੈਂਟ ਹੋਵੇ ਤਾਂ ਇੱਕ ਮਹੀਨੇ 'ਚ ਵੀ ਨਜ਼ਰ ਆਉਣ ਲੱਗ ਜਾਂਦੀ ਹੈ ਸਰ ਪ੍ਰੈਕਟਿਸ ਤਾਂ ਉਹ ਕਰ ਰਿਹਾ ਪਰ ਤੁਹਾਡੇ ਵੱਲੋਂ ਵੀ ਅੱਗੋਂ ਉਹਨੂੰ ਉਹਦੇ ਵੱਲ ਦਿੱਤਾ ਜਾਣਾ ਚਾਹੀਦਾ ਨਾ ਕਿ ਤੁਸੀਂ ਉਸ ਦੀ ਪ੍ਰੋਪਰ ਕੇਅਰ ਕਰੋ ਨਹੀਂ ਸਰ ਤੁਸੀਂ ਉਹਨੂੰ ਪਿੱਛੇ ਬਿਠਾਉਂਦੇ ਆ ਨਾ ਉਸਨੂੰ ਅੱਗੇ ਬਿਠਾ ਕੇ ਆਪਣੇ ਪਾਸ ਬਿਠਾ ਕੇ ਸਿਖਾਓ ਨਹੀਂ ਸਰ ਅਸੀਂ ਵੀ ਫੀਸ ਬਾਕੀ ਬੱਚਿਆਂ ਦੇ ਬਰਾਬਰ ਹੀ ਤੁਹਾਨੂੰ ਦੇਈ ਜਾਂਦੇ ਹਾਂ ਨਾ ਇਹ ਤਾਂ ਹੈ ਨਹੀਂ ਅਸੀਂ ਤੁਹਾਨੂੰ ਫੀਸ ਘੱਟ ਦੇਈ ਜਾਂਦੇ ਹਾਂ ਪਰ ਉਹਦੇ ਨਾਲ ਦੇ ਜਿਹੜੇ ਦੋਸਤ ਹੈ ਬ ਬਹੁਤ ਵਧੀਆ ਮਿਊਜਿਕ ਵਜਾ ਲੈਂਦੇ ਹਨ ਜਾਂ ਸਿੱਖ ਰਹੇ ਹਨ ਨਹੀਂ ਸਰ ਇਹਦੇ ਨਾਲ ਹੀ ਕਈ ਦੋਸਤ ਹਨ ਜਿਹੜੇ ਦੋ ਮਹੀਨੇ ਹੋਏ ਆ ਉਨ੍ਹਾਂ ਨੂੰ ਆਉਂਦੇ ਹੋਏ ਪਰ ਉਹ ਇਹਦੇ ਤੋਂ ਚੰਗਾ ਪ੍ਰਫੋਮ ਕਰ ਰਹੇ ਹਨ ਇਸ ਟਾਈਮ ਸਰ ਮੇਰੇ ਵੱਲੋਂ ਬੇਨਤੀ ਹੈ ਕਿ ਉਸ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਓ ਤੁਸੀਂ ਠੀਕ ਹੈ ਸਰ